ਹੈਲੋ ਸਰ ਪੇਰੈਂਟਸ ਆਪਣੀ ਗੱਲ ਸਰ ਪੇਰੈਂਟਸ ਨਾਲ ਹੋ ਰਹੀ ਹੈ ਜੀ ਫਿਰ ਮੈਂ ਆਪਣੇ ਬੱਚਿਆਂ ਦੇ ਤੁਸੀਂ ਕਿਹੜੇ ਸਕੂਲ 'ਚ ਲਾਏ ਨੇ ਆਪਣੇ ਅੱਛਾ ਜੀ

ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਹਾਂਜੀ ਜੀ ਹਾਂਜੀ ਸਰ ਸਰ ਕੋਈ ਪੇਰੈਂਟਸ ਦੀ ਪੇਰੈਂਟਸ ਮੀਟਿੰਗ ਵਗੈਰਾ ਵੀ ਹੁੰਦੀ ਹੈ ਰੈਗੂਲਰ ਠੀਕ ਹੈ ਸਰ ਅਤੇ ਅਤੇ ਬਾਕੀ ਸਰ ਫੀਸ ਕ੍ਰਟੀਰੀਆ ਕੀ ਇਹਨਾਂ ਦਾ ਅੱਛਾ ਜੀ

ਹਾਂਜੀ ਸਰ ਹਾਂਜੀ ਸਰ ਹਾਂਜੀ ਅਤੇ ਸਰ ਇਹ ਜੇ ਜਿਹੜੇ ਤੁਸੀਂ ਮੈਨੂੰ ਦੱਸੇ ਓ ਇਹਨਾਂ ਵਿੱਚ ਇਨਡੋਰ ਅਤੇ ਆਉਟਡੋਰ ਦੋਨੇ ਹੀ ਖਿਡਾਈਆਂ ਜਾਂਦੀਆ

ਓਕੇ ਸਰ ਠੀਕ ਹੈ ਸਰ ਠੀਕ ਹੈ ਜੀ

ਠੀਕ ਹੈ ਓਕੇ